ਜਿੱਥੇ ਪਰਿਵਾਰ ਵਿੱਚ ਚਾਰ ਪੰਜ ਵਿਅਕਤੀ ਰਹਿੰਦੇ ਹਨ ਤਾਂ ਮਨ ਮੁਟਾਵ ਹੁੰਦੇ ਹੀ ਰਹਿੰਦੇ ਹਨ ਇਸਦਾ ਮੁੱਖ ਕਾਰਨ ਮੋਬਾਈਲ ਫ਼ੋਨ ਹੈ ਕਿਉਂਕਿ ਲੋਕ ਮੋਬਾਈਲ ਫ਼ੋਨ ਦੇ ਕਾਰਨ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਆਪਨ ਟਾਈਮ ਬਿਲਕੁਲ ਨਹੀਂ ਦੇ ਪਾਉਂਦੇ ਕਈ ਲੋਕ ਬਹਾ ਜ਼ਿਆਦਾਤਰ ਬਾਹਰ ਹੀ ਰਹਿੰਦੇ ਹਨ ਅਤੇ ਉਹ ਘਰ ਦੇ ਵਿਅਕਤੀਆਂ ਨਾਲ਼ ਬਿਲਕੁਲ ਹੀ ਚੰਗਾ ਵਿਵਹਾਰ ਨਹੀਂ ਕਰ ਪਾਉਂਦੇ ਕਿਉਂਕਿ ਉਹ ਬਾਹਰੀ ਵਿਅਕਤੀਆਂ ਨਾਲ਼ ਹੀ ਵਧੇਰੇ ਖੁਸ਼ ਰਹਿੰਦੇ ਹਨ ਇਸ ਤੋਂ ਇਲਾਵਾ ਪੁਰਾਣੇ ਸਮਿਆਂ ਵਿੱਚ ਵਿਅਕਤੀ ਇਕੱਠੇ ਬੈ ਮਿਲ਼ ਕੇ ਬੈਠਦੇ ਸਨ ਅਤੇ ਆਪਣੀਆਂ ਗੱਲਾਂ ਨੂੰ ਇੱਕ ਦੂਜੇ ਨਾਲ਼ ਵੰਡਦੇ ਸਨ ਆਪਣੇ ਦੁੱਖ ਸੁੱਖ ਨੂੰ ਵੰਡਾਉਂਦੇ ਸਨ ਅਤੇ ਉਹਨਾਂ ਦਾ ਪਿਆਰ ਵਧੇਰੇ ਬਣਿਆ ਰਹਿੰਦਾ ਸੀ ਪਰ ਅੱਜ ਕੱਲ੍ਹ ਦੇ ਸਮੇਂ ਵਿੱਚ ਬਿਲਕੁਲ ਹੀ ਉੱਲਟ ਹੈ ਕਿਉਂਕਿ ਲੋਕ ਆਪਣਾ ਟਾਈਮ ਇੱਕ ਦੂਜੇ ਨੂੰ ਨਹੀਂ ਦੇ ਪਾ ਰਹੇ ਹਾਲ ਹੀ ਵਿੱਚ ਸਾਡੇ ਗੁਆਂਢ ਵਿੱਚ ਦੋ ਭਰਾਵਾਂ ਦੀ ਲੜ੍ਹਾਈ ਹੋ ਗਈ ਜੋ ਕਿ ਲੜਾਈ ਜ਼ਮੀਨ ਦੇ ਕਾਰਨ ਹੋਈ ਸੀ ਉਨ੍ਹਾਂ ਨੇ ਉਨ੍ਹਾਂ ਨੇ ਉਹਨਾਂ ਦੀ ਇਹ ਲੜਾਈ ਖੇਤ ਵਿੱਚ ਹੋਈ ਸੀ ਅਤੇ ਉਹਨਾਂ ਨੇ ਇੱਕ ਦੂਜੇ ਨੂੰ ਬਹੁਤ ਹੀ ਨੁਕਸਾਨ ਪਹੁੰਚਾਇਆ ਅਤੇ ਉਨ੍ਹਾਂ ਦਾ ਸਰੀਰਕ ਨੁਕਸਾਨ ਵੀ ਵਧੇਰੇ ਹੋਇਆ ਇਸ ਤੋਂ ਬਾਅਦ ਗੱਲ ਪੁਲਿਸ ਤੱਕ ਪਹੁੰਚ ਗਈ ਇੱਕ ਇੱਕ ਪੱਖ ਨੇ ਦੂਜੇ ਪੱਖ 'ਤੇ ਕੇਸ ਕਰ ਦਿੱਤਾ ਜਿਸ ਦੇ ਕਾਰਨ ਪੈਸਾ ਵਧੇਰੇ ਲੱਗਿਆ